ਹਾਂਜੀ ਪ੍ਰਦਰਸ਼ਨ ਨੂੰ ਵਧਾਉਣ ਲਈ ਗਾਉਂਦੇ ਸਮੇਂ ਸਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆ ਜਿੱਦਾਂ ਆਪਣੇ ਸਰੀਰ ਨੂੰ ਅਤੇ ਚਿਹਰੇ ਦੇ ਹਾਵ ਭਾਵ ਦੀ ਵਰਤੋਂ ਸਾਨੂੰ ਗਾਣੇ ਦੇ ਅਨੁਸਾਰ ਕਰਨੀ ਪੈਂਦੀ ਹੈ ਸਾਨੂੰ ਆਪਣੇ ਸਰੀਰ ਨੂੰ ਉਨਾ ਕੁ ਹੀ ਵਰਤਣਾ ਚਾਹੀਦਾ ਹੈ ਜਿੰਨਾ ਕੁ ਗਾਣੇ ਵਿੱਚ ਲੋੜ ਹੋਵੇ ਸਾਨੂੰ ਗਾਉਂਦੇ ਸਮੇਂ ਆਪਣੇ ਚਿਹਰੇ 'ਤੇ ਮੁਸਕਰਾਹਟ ਰੱਖਣੀ ਚਾਹੀਦੀ ਹੈ ਗਾਣੇ ਦੇ ਹਿਸਾਬ ਨਾਲ ਜਿੱਥੇ ਸਾਨੂੰ ਲੋੜ ਪਵੇ ਆਪਣੇ ਹੱਥ ਦੀ ਬਾਂਹ ਦੀ ਵਰਤੋਂ ਕਰਨੀ ਚਾਹੀਦੀ ਹੈ ਜਿੱਥੇ ਸਾਨੂੰ ਹੇਕ ਲਾਉਣ ਦੀ ਲੋੜ ਪੈਂਦੀ ਹੈ ਉੱਥੇ ਅਸੀਂ ਆਪਣੇ ਪ੍ਰੋਪਰ ਹੱਥ ਦੀ ਅਤੇ ਬਾਂਹ ਦੀ ਵਰਤੋਂ ਕਰਦੇ ਹਾਂ ਗਾਉਂਦੇ ਸਮੇਂ ਹੋਰ ਸਾਨੂੰ ਆਪਣੇ ਸਰੀਰ ਦੇ ਪੈਰਾਂ ਦੀ ਜਿੱਥੇ ਥੋੜ੍ਹਾ ਬਹੁਤਾ ਨੱਚਣ ਦੀ ਲੋੜ ਪਵੇ ਗਾਣੇ ਦੇ ਅਨੁਸਾਰ ਥੋੜ੍ਹਾ ਬਹੁਤਾ ਨੱਚ ਵੀ ਸਕਦੇ ਹਾਂ ਅਤੇ ਆਪਣੇ ਚਿਹਰੇ ਦੇ ਹਾਵ ਭਾਵ ਜਿੱਦਾਂ ਸਾਨੂੰ ਆਪਣੇ ਚਿਹਰੇ 'ਤੇ ਖੁਸ਼ੀ ਰੱਖਣੀ ਚਾਹੀਦੀ ਹੈ ਤਾਂ ਜੋ ਸਾਡਾ ਪ੍ਰਦਰਸ਼ਨ ਵੱਧ ਸਕੇ ਲੋਕ ਸਾਨੂੰ ਦੇਖ ਕੇ ਹੋਰ ਖੁਸ਼ ਹੋਣ ਸਾਡੇ ਇੱਕ ਵਾਰੀ ਮੈਂ ਆਪਣੀ ਕਲਾਸ ਵਿੱਚ ਇਹ ਆਪਣੀ ਮੈਡਮ ਨੂੰ ਗਾਣਾ ਸੁਣਾਇਆ ਸੀ ਮੇਰੀ ਮੈਡਮ ਨੂੰ ਮੇਰਾ ਗਾਣਾ ਬਹੁਤ ਹੀ ਪਸੰਦ ਆਇਆ ਸੀਗਾ ਅਤੇ ਉਹਨਾਂ ਨੇ ਮੇਰੀ ਬਹੁਤ ਹੀ ਤਾਰੀਫ ਕੀਤੀ ਸੀਗੀ ਇਸ ਤਰ੍ਹਾਂ ਸਾਨੂੰ ਆਪਣੇ ਗਾਉਂਦੇ ਸਮੇਂ ਸਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਥੈਂਕ ਯੂ